ਅੱਜ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਜਾ ਰਹੀ ਹਾਂ ਇਹ ਐਕਸਪੀਰੀਅੰਸ ਮੇਰਾ ਅੱਜ ਦਾ ਬਹੁਤ ਜ਼ਿਆਦਾ ਵਧੀਆ ਅੱਜ ਤੱਕ ਦਾ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਔਨਲਾਈਨ ਸ਼ੋਪਿੰਗ ਦਾ ਮੈਂ ਔਨਲਾਈਨ ਸ਼ੋਪਿੰਗ ਪਹਿਲਾਂ ਕਦੀ ਟਰਾਈ ਨਹੀਂ ਕੀਤੀ ਸੀ ਬਟ ਇਸ ਇੱਕ ਵਾਰ ਮੈਂ ਸੋਚਿਆ ਕਿ ਚਲੋ ਮੈਂ ਇੱਕ ਵਾਰ ਟਰਾਈ ਕਰਕੇ ਦੇਖਦੀ ਹਾਂ ਪਹਿਲਾਂ ਮੈਂ ਬਹੁਤ ਜ਼ਿਆਦਾ ਡਰਦੀ ਸੀਗੀ ਕਿ ਔਨਲਾਈਨ ਸ਼ੋਪਿੰਗ ਕਰੂੰਗੀ ਤਾਂ ਕਿੱਦਾਂ ਦਾ ਪ੍ਰੋਡਕਟ ਆਏਗਾ ਬਟ ਜਦੋਂ ਮੈਂ ਟਰਾਈ ਕੀਤਾ ਮੈਂ ਐਮਾਜ਼ੋਨ ਤੋਂ ਟ੍ਰਾਈ ਕੀਤਾ ਮੈਂ ਸੋਚਿਆ ਕਿ ਚਲੋ ਇੱਕ ਵਾਰ ਔਡਰ ਕਰਕੇ ਦੇਖਦੀ ਹਾਂ ਮੈਂ ਐਮਾਜ਼ੋਨ ਤੋਂ ਪਹਿਲਾਂ ਤਾਂ ਦੇਖਿਆ ਸਾਰੇ ਪ੍ਰੋਡਕਟਸ ਮੈਂ ਜਦੋਂ ਦੇਖਿਆ ਤਾਂ ਦਿਵਾਲੀ ਦੀ ਔਫ ਲੱਗੀ ਹੋਈ ਸੀ ਜਿਹੜੇ ਹੈਡਫੋਨਸ ਮੈਨੂੰ ਬਾਜ਼ਾਰੋਂ ਤਿੰਨ ਹਜ਼ਾਰ ਦੇ ਪੈ ਰਹੇ ਸੀ ਉਹ ਮੈਨੂੰ ਕੇਵਲ ਅੱਠ ਸੌ ਦੇ ਪਏ ਤਾਂ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਮੰਗਵਾ ਕੇ ਦੇਖਦੀ ਹਾਂ ਜਦੋਂ ਮੈਂ ਉਹਨਾਂ ਨੂੰ ਮੰਗਵਾਇਆ ਤਾਂ ਉਹ ਇੰਨੇ ਜ਼ਿਆਦਾ ਸ਼ਾਨਦਾਰ ਨਿਕਲੇ ਉਹਦਾ ਬੈਟਰੀ ਬੈਕਅਪ ਵੀ ਬਹੁਤ ਜ਼ਿਆਦਾ ਵਧੀਆ ਸੀ ਅੱਜ ਤਾਂ ਮੈਨੂੰ ਉਹ ਲਿਤੇ ਇੱਕ ਪੂਰਾ ਇੱਕ ਸਾਲ ਹੋ ਗਿਆ ਬਟ ਉਹਦੀ ਕੁਆਲਿਟੀ ਉੱਦਾਂ ਦੀ ਉੱਦਾਂ ਹੀ ਹੈ ਉਹ ਮੈਨੂੰ ਇੱਦਾਂ ਅਜੇ ਤੱਕ ਇੱਦਾਂ ਲੱਗਦਾ ਹੈ ਕਿ ਅਜੇ ਮੈਂ ਨਵੇਂ ਹੀ ਖਰੀਦੇ ਹੋਣ ਤਾਂ ਮੈਂ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੇਰਾ ਤਾਂ ਉਸ ਤੋਂ ਬਾਅਦ ਟਰੱਸਟ ਬਣ ਹੀ ਗਿਆ ਕਿ ਮੈਂ ਇੱਥੋਂ ਹੀ ਮੰਗਵਾਉਣਾ ਅਤੇ ਸ ਉਹ ਵੀ ਬਹੁਤ ਸਸਤੇ ਪ੍ਰਾਈਜ਼ ਦੇ ਵਿੱਚ